ਮਨੁੱਖ ਹਮੇਸ਼ਾ ਆਪਣੀਆਂ ਜੜਾਂ ਨਾਲ ਜੁੜਨਾ ਚਾਹੁੰਦਾ ਹੈ ਠੀਕ ਹੀ ਹੈ ਛੋਟੇ ਹੁੰਦਿਆਂ ਯਾਦਾਂ ਸਾਰੀ ਜ਼ਿੰਦਗੀ ਮਿੱਠਾ ਅਹਿਸਾਸ ਦਿੰਦੀਆਂ ਹਨ ਅਸੀਂ ਅਮਰੂਦ ਦੇ ਪੇੜ 'ਤੇ ਚੜ ਕੇ ਅਮਰੂਦ ਤੋੜ ਕੇ ਖਾਂਦੇ ਹੁੰਦੇ ਸੀ ਸਾਡੇ ਮੰਮੀ ਨੂੰ ਖੇਤੀਬਾੜੀ ਦਾ ਬਹੁਤ ਸ਼ੌਂਕ ਸੀ ਉਹ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਉਗਾਇਆ ਕਰਦੇ ਸਨ ਜਿਵੇਂ ਭਿੰਡੀ ਤੋਰੀ ਟਮਾਟਰ ਗਾਜਰ ਲਸਣ ਹਲਦੀ ਪਿਆਜ਼ ਵਗੈਰਾ ਹੋਰ ਵੀ ਬਹੁਤ ਕੁਝ ਅਸੀਂ ਰੋਜ਼ ਉੱਠ ਕੇ ਖੇਡਦੇ ਸੀ ਅਸੀਂ ਸਬਜ਼ੀ ਕਿੰਨੀ ਵੱਡੀ ਹੋ ਗਈ ਰੋਜ਼ ਦੇਖਦੇ ਸੀ ਫਿਰ ਅਸੀਂ ਗਾਵਾਂ ਮੱਝਾਂ ਵੀ ਰੱਖੀਆਂ ਹੋਈਆਂ ਸਨ ਰੋਜ਼ ਪਾਪਾ ਜਦੋਂ ਦੁੱਧ ਚੋਣ ਜਾਂਦੇ ਸਾਨੂੰ ਨਾਲ ਲੈ ਜਾਂਦੇ ਅਸੀਂ ਵੀ ਥਣਾ ਨੂੰ ਹੱਥ ਲਾ ਕੇ ਦੁੱਧ ਚੋਣ ਦੀ ਕੋਸ਼ਿਸ਼ ਕਰਦੇ ਅਤੇ ਤਾਜ਼ਾ ਹੋਇਆ ਦੁੱਧ ਤਾਜ਼ਾ ਚੋਇਆ ਹੋਇਆ ਦੁੱਧ ਪੀਂਦੇ ਬਹੁਤ ਸਾਰੀਆਂ ਬਹੁਤ ਮਜ਼ਾ ਆਉਂਦਾ ਸੀ ਅਸੀਂ ਕੁੱਤੀ ਅਤੇ ਬਿੱਲੀ ਵੀ ਪਾਲੇ ਹੋਏ ਸਨ ਦੋਵੇਂ ਜਾਨਵਰ ਬੜੇ ਪਿਆਰ ਨਾਲ ਖੇਡਦੇ ਸਨ ਅਤੇ ਸਾਡੇ ਨਾਲ ਹੀ ਸੋਂਦੇ ਸਨ ਅਸੀਂ ਮਿੱਟੀ ਵਿੱਚ ਖੇਡਦੇ ਸੀ ਬਹੁਤ ਵਧੀਆ ਲੱਗਦਾ ਸੀ ਸਕੂਲ ਪੜ੍ਹਦੇ ਸਾਂ ਪਰ ਫਿਕਰ ਨਹੀਂ ਸੀ ਹੁੰਦਾ ਪੜ੍ਹਾਈ ਦਾ ਹਮੇਸ਼ਾ ਖੁਸ਼ ਰਹਿੰਦੇ ਸਾਂ ਗਹਿਰੀ ਨੀਂਦ ਸੋਂਦੇ ਸਾਂ ਉਹ ਦਿਨ ਭੁੱਲਦੇ ਨਹੀਂ ਇਸ ਤਰ੍ਹਾਂ ਅਸੀਂ ਆਪਣੀ ਮਿੱਟੀ ਨਾਲ ਜੁੜੇ ਹੋਏ ਸਾਂ